ਜਦੋਂ ਮੈਂ ਆਪਣੇ ਬਾਗ ਨੂੰ ਪਾਣੀ ਦੇ ਰਹੀ ਸੀ ਤਾਂ ਮੈਂ ਦੇਖਿਆ ਜਿਹੜਾ ਹੋਜ ਸੀ ਉਹਦੇ ਵਿੱਚੋਂ ਬਹੁਤ ਹੀ ਕਮਜ਼ੋਰ ਧਾਰਾ ਨਿਕਲ ਰਹੀ ਸੀ ਅਤੇ ਉਹ ਸਭ ਤੋਂ ਪਹਿਲਾਂ ਤਾਂ ਮੈਂ ਪਾਈਪ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਉਹਨੂੰ ਬਹੁਤ ਚੰਗੀ ਤਰ੍ਹਾਂ ਸਾਫ ਕੀਤਾ ਫੇਰ ਬਟ ਫਿਰ ਵੀ ਧਾਰਾਂ ਉਹਦੀ ਜਿਹੜੀ ਪੂਰੀ ਤਰ੍ਹਾਂ ਨਹੀਂ ਅੱਛੀ ਆ ਰਹੀ ਸੀ ਤੇਜ਼ ਆ ਰਹੀ ਸੀ ਫਿਰ ਮੈਂ ਉਹਨੂੰ ਅਤੇ ਦੇਖਿਆ ਕਿ ਉਹਦੇ ਵਿੱਚ ਕੋਈ ਹਵਾ ਤਾਂ ਨਹੀਂ ਭਰ ਗਈ ਹੈ ਅਤੇ ਉਹ ਵੀ ਮੇਰੇ ਵੱਲੋਂ ਤਾਂ ਠੀਕ ਸੀ ਬਿਲਕੁਲ ਅਤੇ ਫਿਰ ਉਸ ਤੋਂ ਬਾਅਦ ਜਦ ਮੈਨੂੰ ਇਸ ਆਪਣੇ ਐਂਡ ਤੇ ਕੁਛ ਵੀ ਨਹੀਂ ਪਤਾ ਲੱਗਿਆ ਅਤੇ ਫਿਰ ਮੈਂ ਜਿਹੜਾ ਕਿ ਹੈਗਾ ਜਲ ਅਥੋਰਟੀ ਹੈ ਉਹਨੂੰ ਸੰਪਰਕ ਕਰਨ ਦੀ ਸੋਚੀ ਅਤੇ ਫਿਰ ਮੈਂ ਉਹਨਾਂ ਦਾ ਇੰਟਰਨੈਟ ਤੋਂ ਨੰਬਰ ਲੱਭਿਆ ਅਤੇ ਮੈਂ ਉੱਥੇ ਫੋਨ ਕੀਤਾ ਫੋਨ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਇਹ ਸਾਰੀ ਆਪਣੀ ਸਮੱਸਿਆ ਬਾਰੇ ਦੱਸਿਆ ਤੇ ਦੱਸਣ ਦਾ ਉਸ ਫਿਰ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਉਹ ਆਪਣਾ ਕੋਈ ਵੀ ਟੈਕਨੀਸ਼ਨ ਜਿਹੜਾ ਹੈਗਾ ਉਹ ਮੈਨੂੰ ਭੇਜਣ ਤਾਂ ਕਿ ਮੈਂ ਆਪਣੇ ਜਿਹੜਾ ਬਾਗ ਹੈ ਉਹਨੂੰ ਪੂਰੀ ਤਰ੍ਹਾਂ ਪਾਣੀ ਪ੍ਰੋਪਰਲੀ ਦੇ ਸਕਾਂ ਕਿਉਂਕਿ ਪਾਣੀ ਦੇਣ 'ਚ ਮੈਨੂੰ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਹੈ ਅਤੇ ਮੈਂ ਐਕਚੁਲੀ ਪਹਿਲਾਂ ਆਪਣੇ ਆਸ ਪਾਸ ਵੀ ਕਿਸੇ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਕਹਿੰਦੇ ਕਿ ਇਹ ਪਿੱਛੋਂ ਹੀ ਜਲ ਜਿਹੜਾ ਹੈਗਾ ਵਿਭਾਗ ਹੈ ਉਹ ਹੀ ਦੇਖ ਪਾਏਗਾ ਇਹਨੂੰ ਅਤੇ ਮੈਂ ਬੇਨਤੀ ਕਰਦੀ ਹਾਂ ਤੁਹਾਨੂੰ ਕਿ ਪਲੀਜ਼ ਮੇਰਾ ਜਲਦੀ ਤੋਂ ਜਲਦੀ ਇਹ ਕੰਮ ਕਰਵਾ ਦਿਓ ਕਿਉਂਕਿ ਮੈਂ ਆਪਣੀ ਬਾਗ ਵਿੱਚ ਇਕੱਲਾ ਫੁੱਲ ਹੀ ਨਹੀਂ ਸਗੋਂ ਮੈਂ ਆਪਣਾ ਇੱਕ ਸਬਜ਼ੀਆਂ ਦਾ ਬਾਗ ਵੀ ਬਣਾਇਆ ਹੋਇਆ ਹੈ ਅਤੇ ਜੇ ਉਹਨਾਂ ਨੂੰ ਪ੍ਰੋਪਰਲੀ ਨਹੀਂ ਪਾਣੀ ਮਿਲਿਆ ਤਾਂ ਫਿਰ ਇਹ ਬਹੁਤ ਜ਼ਿਆਦਾ ਔਖਾ ਹੋ ਜਾਏਗਾ ਅਤੇ ਮੈਂ ਕਹਿ ਚਾਹੁੰਦੀ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਮੇਰੀ ਇਸ ਹੱਲ ਦਾ ਨਿਵਾਰਣ ਕਰੋ